ਵਾਇਰ ਕਟਰ ਮੈਂ ਇੱਕ ਐਮਾਜੋਨ ਤੋਂ ਓਡਰ ਕੀਤਾ ਸੀਗਾ ਉਹਦੇ ਨਾਲ ਤਾਰ ਕੱਟਣ 'ਚ ਕਾਫੀ ਮੈਨੂੰ ਦਿੱਕਤ ਆਈ ਕਿਉਂਕਿ ਉਹਦੇ ਨਟ ਢਿੱਲੇ ਹੋ ਗਏ ਸੀਗੇ ਤਾਂ ਤਾਰ ਕੱਟਣ 'ਚ ਕਾਫੀ ਮੁਸ਼ਕਿਲ ਸੀ